ਚੌਵੀ ਅਗਸਤ ਉੱਨੀ ਸੌ ਇਕਾਸੀ ਬਾਰਾਂ ਫਰਵਰੀ ਉੱਨੀ ਸੌ ਪਚਾਸੀ ਪੰਜ ਫਰਵਰੀ ਦੋ ਹਜ਼ਾਰ ਛੇ ਤੇਰ੍ਹਾਂ ਦਸੰਬਰ ਦੋ ਹਜ਼ਾਰ ਅੱਠ ਚੌਦਾਂ ਜੁਲਾਈ ਦੋ ਹਜ਼ਾਰ ਚੌਦਾਂ